ਭਾਰਤ ਦੇ ਪੰਜਾਬ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਬੋਲੀ ਕਹਿੰਦੇ ਹਨ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖਿਆ ਜਾਂਦਾ ਹੈ ਜਿਸ ਵਿੱਚ ਪੈਂਤੀ ਅੱਖਰ ਹੁੰਦੇ ਸਨ ਪਹਿਲਾਂ ਅਤੇ ਹੁਣ ਇਸ ਵਿੱਚ ਛੇ ਅੱਖਰ ਹੋਰ ਜੁੜ ਗਏ ਹਨ ਜਿਵੇਂ ਕਿ ਸ ਪੈਰ ਬਿੰਦੀ ਖ ਦੇ ਪੈਰ ਬਿੰਦੀ ਜ ਪੈਰ ਬਿੰਦੀ ਫ ਪੈਰ ਬਿੰਦੀ ਲ ਪੈਰ ਬਿੰਦੀ ਆਦਿ ਅਤੇ ਇਸ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਨੇ ਤਿਆਰ ਕੀਤਾ ਸੀ ਇਸ ਵਿੱਚ ਲੰਡੇ ਅੱਖਰਾਂ ਵਾਲੀ ਪੰਜਾਬੀ ਲਿਖਤ ਵੀ ਹੈ ਜਿਸ ਵਿੱਚ ਮਾਤਰਾਵਾਂ ਨਹੀਂ ਹਨ ਅਤੇ ਉਸ ਤੋਂ ਬਾਅਦ ਜੋੜਵੇਂ ਅੱਖਰਾਂ ਵਾਲੀ ਪੰਜਾਬੀ ਲਿਖਤੀ ਤਿਆਰ ਹੋਈ ਜਿਸ ਵਿੱਚ ਸਾਰੇ ਸ਼ਬਦ ਜੁੜੇ ਹੋਏ ਹਨ ਅਤੇ ਇਸ ਤੋਂ ਬਾਅਦ ਜੋੜਵੇਂ ਸ਼ਬਦ ਨੂੰ ਵੱਖ ਵੱਖ ਕਰਕੇ ਲਿਖਿਆ ਜਾਣ ਲੱਗਾ ਅਤੇ ਇਸ ਵਿੱਚ ਕਈ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਲਿੱਤੇ ਗਏ ਹਨ ਜਿਵੇਂ ਕਿ ਇੰਗਲਿਸ਼ ਵਿੱਚ ਯੂਨੀਵਰਸਿਟੀ ਅਤੇ ਸਕੂਲ ਆਦਿ ਕਿਹਾ ਜਾਂਦਾ ਹੈ ਅਤੇ ਪੰਜਾਬੀ ਵਿੱਚ ਵੀ ਇਹਨਾਂ ਨੂੰ ਯੂਨੀਵਰਸਿਟੀ ਅਤੇ ਸਕੂਲ ਹੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ